ਚਿੱਤਰਕਾਰੀ ਕਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਇਸ ਲਈ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਚਿੱਤਰਕਾਰੀ ਕਰਦੇ ਸਮੇਂ ਆਸੇ ਪਾਸੇ ਕੋਈ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਜਿਸ ਚੀਜ਼ ਦਾ ਅਸੀਂ ਚਿੱਤਰ ਬਣਾ ਰਹੇ ਹਾਂ ਉਸ 'ਤੇ ਫੋਕਸ ਹੋਣਾ ਚਾਹੀਦਾ ਹੈ ਮੇਰੇ ਪਸੰ ਪਸੰਦੀਦਾ ਬਰਾਂਡ ਡੋਮਸ ਅਤੇ ਆਰਟ ਕਲਰ ਹਨ ਅਤੇ ਚਿੱਤਰ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਪੇਪਰ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਤੋਂ ਬਾਅਦ ਪੈਨਸਲ ਵਾਟਰ ਕਲਰ ਸਕੈੱਚ ਕਲਰ ਪੈਨਸਲ ਕਲਰ ਮੋਮੀ ਕਲਰ ਅਤੇ ਰੇਜਰ ਦੀ ਜ਼ਰੂਰਤ ਪੈਂਦੀ ਹੈ ਮੈਂ ਇਹ ਸਾਰੀਆਂ ਚੀਜ਼ਾਂ ਛਾਇਆ ਬੁੱਕ ਡੀਪੂ ਤੋਂ ਖਰੀਦਦੀ ਹਾਂ ਸਟੇਸ਼ਨਰੀ ਦਾ ਸਮਾਨ ਬਹੁਤ ਮਹਿੰਗਾ ਪੈਂਦਾ ਹੈ ਜੇਕਰ ਅਸੀਂ ਇਹ ਸਾਰਾ ਸਮਾਨ ਚੰਗੀ ਕੁਆਲਿਟੀ ਦਾ ਵਰਤਣਾ ਚਾਹੁੰਦੇ ਹਾਂ ਤਾਂ ਇਹ ਮਹਿੰਗਾ ਹੈ ਅਤੇ ਆਮ ਲੋਕ ਇਸ ਨੂੰ ਅਫੋਰਡ ਨਹੀਂ ਕਰ ਸਕਦੇ